ਮੈਂ ਕੋਈ ਵੀ ਸੰਗੀਤ ਸਾਜ਼ ਨਹੀਂ ਵਜਾਉਂਦੀ ਇਹ ਮੈਨੂੰ ਵਜਾਉਣਾ ਨਹੀਂ ਆਉਂਦਾ ਪਰ ਮੈਂ ਜੋ ਹੁਨਰ ਹਾਸਲ ਕਰਨਾ ਚਾਹੁੰਦੀ ਹਾਂ ਉਹ ਮੇਰਾ ਹੁਨਰ ਇੱਕ ਲੇਖਕ ਬਣਨਾ ਹੈ ਮੈਂ ਇੱਕ ਵੱਡਾ ਲੇਖਕ ਬਣਨਾ ਚਾਹੁੰਦੀ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਾਹਿਤ ਲਿਖ ਕੇ ਆਪਣਾ ਨਾਮ ਉਹਨਾਂ ਚੰਗੇ ਲੇਖਕਾਂ ਦੇ ਵਿੱਚ ਛੂਮਾਰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇ ਕਿਉਂਕਿ ਕੋਈ ਵੀ ਇਨਸਾਨ ਜਦੋਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਹੁਨਰ ਦੇ ਰਾਹੀਂ ਆਪਣਾ ਮੁਕਾਮ ਹਾਸਲ ਕਰ ਲੈਂਦਾ ਹੈ ਤਾਂ ਉਹਦੀ ਵੱਖਰੀ ਪਛਾਣ ਹੋ ਜਾਂਦੀ ਹੈ ਆਪਣੀ ਵੱਖਰੀ ਪਛਾਣ ਦੇ ਰਾਹੀਂ ਉਹ ਸਾਰੇ ਲੋਕਾਂ ਦੇ ਵਿੱਚ ਜਾਣਿਆ ਜਾਣ ਲੱਗ ਜਾਂਦਾ ਹੈ ਮੇਰੇ ਮਨ ਦੀ ਇਹੋ ਇੱਛਾ ਰਹੀ ਹੈ ਕਿ ਮੈਂ ਵੀ ਇੱਕ ਅਜਿਹਾ ਹੀ ਲਿਖਣ ਦਾ ਜੋ ਮੈਨੂੰ ਹੁਨਰ ਹੈ ਉਸ ਦੇ ਰਾਹੀਂ ਇੱਕ ਵੱਡਾ ਲੇਖਕ ਬਣ ਜਾਵਾਂ ਅਤੇ ਉਸ ਲੇਖਕ ਨੂੰ ਸਾਰੇ ਜਾਣਦੇ ਹੋਣ ਉਸ ਦੇ ਸਾਹਿਤ ਨੂੰ ਪੜ੍ਹ ਕੇ ਸਭ ਨੂੰ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣ ਅਤੇ ਚੰਗੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਣ ਸਕਣ